ਟੈਕਨੋਲੋਜ਼ੀ ਨੇ ਮੇਰਾ ਕ ਕਾਰੋਬਾਰ ਵਧਾਉਣ ਵਿੱਚ ਇਸ ਤਰੀਕੇ ਨਾਲ ਮਦਦ ਕੀਤੀ ਹੈ ਕਿ ਮੈਂ ਜਦੋਂ ਕੋਲਜ ਵਿੱਚ ਸੀ ਤਾਂ ਮੈਂ ਬੀਟੈਕ ਦਾ ਸਟੂਡੈਂਟ ਸੀ ਤਾਂ ਮੇਰਾ ਜ਼ਿਆਦਾ ਧਿਆਨ ਪੜ੍ਹਾਈ ਵੱਲ ਨ ਨਹੀਂ ਸੀ ਤਾਂ ਮੈਨੂੰ ਸ਼ੌਂਕ ਸੀ ਗੌਰਮੈਂਟ ਜੋਬ ਦਾ ਅਤੇ ਗੌਰਮੈਂਟ ਜੋਬ ਮੈਂ ਬਹੁਤ ਵਾਰੀ ਟਰਾਈ ਕੀਤੀ ਕੁਛ ਨਹੀਂ ਹੋਇਆ ਮੈਨੂੰ ਸ਼ੋਕ ਚੜਿਆ ਲੋਕਾਂ ਨੂੰ ਪੜ੍ਹਾਉਣ ਦਾ ਦੈਨ ਮੈਂ ਇੱਕ ਯੂਟੀਊਬ ਚੈਨਲ ਖੋਲਿਆ ਤੋ ਉਸ ਤੋਂ ਮੈਂ ਵੀਡੀਓਸ ਪਾਉਣ ਲੱਗ ਪਿਆ ਵੀਡੀਓਜ ਪਾ ਪਾ ਲੋਕਾਂ ਨੂੰ ਮੈਂ ਆਪਣੇ ਚੈਨਲ ਬਾਰੇ ਦੱਸਦਾ ਸੀ ਕੋਲਜ ਵਿੱਚ ਸਭ ਨੂੰ ਮੈਂ ਦੱਸਦਾ ਸੀ ਇਹ ਮੇਰਾ ਚੈਨਲ ਆ ਸਸਕ੍ਰਾਈਬ ਕਰੋ ਅਤੇ ਵੀਡੀਓਜ਼ ਵਗੈਰਾ ਦੇਖੋ ਗੌਰਮੈਂਟ ਜੋਬ ਦੀ ਤਿਆਰੀ ਤਿਆਰੀ ਕਰੋ ਜਿਸ ਨਾਲ ਲੋਕਾਂ ਦਾ ਵੀ ਭਲਾ ਹੋਣ ਲੱਗ ਪਿਆ ਫਰੀ 'ਚ ਉਹਨਾਂ ਨੂੰ ਕੋਚਿੰਗ ਮਿਲਣ ਲੱਗ ਪਈ ਦੈਨ ਮੇਰੇ ਪੜ੍ਹਾਉਣ ਨਾਲ ਬਹੁਤ ਲੋਕ ਗੌਰਮੈਂਟ ਜੋਬ ਵੀ ਕਰ ਸਕੇ ਅਤੇ ਮੇਰਾ ਇੱਕ ਦੋਸਤ ਸੀ ਉਸ ਦਾ ਕੰਮ ਸੀ ਗਰੋਸਰੀ ਸ਼ੋਪ ਦਾ ਸੀ ਦੈਨ ਉਸਨੇ ਆਪਣੀ ਦੁਕਾਨ ਦਾ ਸਾਰਾ ਸਮਾਨ ਔਨਲਾਈਨ ਇੱਕ ਵੈਬਸਾਈਟ ਬਣਾਈ ਅਤੇ ਉਸਤੇ ਅਪਲੋਡ ਕਰਤਾ ਜਿਸ ਨੂੰ ਮੈਂ ਆਪਣੇ ਯੂਟਿਊਬ ਚੈਨਲ 'ਤੇ ਉਸਦੀ ਵੀਡੀਓ ਬਣਾ ਕੇ ਵਾਇਰਲ ਕਰਤਾ ਜਿਸ ਨਾਲ ਉਸਦੀ ਦੁਕਾਨ 'ਤੇ ਗਾਹਕੀ ਵੱਧ ਗਈ ਅਤੇ ਉਸਨੇ ਵੀ ਮੇਰਾ ਧੰਨਵਾਦ ਕੀਤਾ ਮੈ